ਪੰਜਾਬ ਵਿੱਚ ਬਹੁਤ ਹੀ ਮਹੱਤਵਪੂਰਨ ਇਤਿਹਾਸ ਨਾਲ਼ ਜੁੜੇ ਹੋਏ ਮੰਦਰ ਕਿਲ੍ਹੇ ਮਹਿਲ ਅਜਾਇਬ ਘਰ ਹਨ ਜਿਹਨਾਂ ਦੇ ਵਿੱਚੋਂ ਦੁਰਗਿਆਨਾ ਮੰਦਰ ਅੰਮ੍ਰਿਤਸਰ ਹੈ ਅਤੇ ਮ ਮਾਤਾ ਮਨਸਾ ਦੇਵੀ ਦਾ ਮੰਦਰ ਜੋ ਹੈ ਵੋ ਚੰਡੀਗੜ੍ਹ ਵਿੱਚ ਹੈਗਾ ਔਰ ਜੋ ਪਟਿਆਲੇ ਦੇ ਵਿੱਚ ਹੈਗਾ ਮ ਮਾਤਾ ਕਾਲੀ ਦਾ ਮੰਦਰ ਹੈਗਾ ਅਜਾਇਬ ਘਰ ਵੀ ਹੈ ਕਾਫ਼ੀ ਔਰ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਵੀ ਹੈ ਔਰ ਸਾਡੇ ਇੱਥੇ ਅ ਮੋਹਾਲੀ ਦੇ ਵਿੱਚ ਅੰਬ ਸਾਹਿਬ ਗੁਰਦੁਆਰਾ ਔਰ ਸੋਹਾਣਾ ਸਾਹਿਬ ਗੁਰਦੁਆਰਾ ਕਾਫ਼ੀ ਮਤਲਬ ਸਾਡੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਪੂਰੇ ਮਤਲਬ ਇਨ੍ਹਾਂ ਇਨ੍ਹਾਂ ਅਜਾ ਮੰਦਰ ਕਿਲ੍ਹੇ ਮਹਿਲ ਅਜਾਇਬ ਘਰ ਦੇ ਨਾਲ਼ ਜੁੜੇ ਹੋਏ ਕਾਫ਼ੀ ਅਸੀਂ ਇਹਨਾਂ ਚੀਜ਼ਾਂ ਨੂੰ ਸੰਭਾਲ਼ ਕੇ ਰੱਖਿਆ ਹੋਇਆ ਹੈਗਾ